ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸੱਭਿਆਚਾਰ ਨੂੰ ਪੰਜਾਬੀ ਭਾਸ਼ਾ ਨੂੰ ਆਪਣੇ ਕਲਚਰ ਨੂੰ ਲੈ ਕੇ ਜੋ ਮੇਰੀ ਵਿਚਾਰਧਾਰਾ ਗੀ ਉਹ ਇਹ ਹੈ ਜੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਘਰ ਪੰਜਾਬੀ ਪੜ੍ਹਾਈ ਜਾਵੇ ਸੋ ਅੱਜ ਦੇਖੋ ਅੱਜ ਦੇ ਟੈਮ ਵਿੱਚ ਇੰਗਲਿਸ਼ ਨੂੰ ਬਹੁਤ ਹੀ ਮਹੱਤਵਪੂਰਨ ਸਮਝਿਆ ਗਿਆ ਜਾ ਰਿਹਾ ਗਾ ਆਪਣੇ ਬੱਚਿਆਂ ਨੂੰ ਘਰ ਘਰ ਦੇ ਵਿੱਚ ਉਹਨਾਂ ਨੂੰ ਕਾਪੀਆਂ ਕਿਤਾਬਾਂ ਜੋ ਕਿ ਪੰਜਾਬੀ ਦੇ ਵਿੱਚ ਜਿਵੇਂ ਪੁਰਾਣੇ ਕਲਚਰ ਦੇ ਵਿੱਚ ਫੱਟੀਆਂ ਪੋਚ ਕੇ ਲਿਖੀਆਂ ਜਾਂਦੀਆਂ ਸੀਗੀਆਂ ਸਿਆਹੀ ਦੇ ਨਾਲ ਉਹ ਉਸ ਦੇ ਨਾਲ ਲਿਖਤ ਜੋ ਹੁੰਦੀ ਸੀਗੀ ਪੰਜਾਬੀ ਭਾਸ਼ਾ ਦੀ ਬੜੀ ਸਾਫ਼ ਸੁਥਰੀ ਹੁੰਦੀ ਸੀਗੀ ਸੋ ਉਹ ਅੱਜ ਦੇ ਟੈਮ 'ਚ ਵੀ ਯੂਜ਼ ਹੋ ਸਕਦੀਆਂ ਹੈਗੀਆਂ ਖਰਚ ਵੀ ਬਹੁਤ ਘੱਟ ਸੀ ਉਹਦਾ ਅਤੇ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਆਪਣੇ ਘਰ ਦੇ ਵਿੱਚ ਫੋਟੋਆਂ ਲਗਾ ਕੇ ਰੱਖੋ ਪੁਰਾਣੇ ਕਲਚਰ ਦੀਆਂ ਪੁਰਾਣੇ ਵਿਚਾਰਾਂ ਦੀਆਂ ਜੋ ਕਿ ਲਿਖਤਾਂ ਸੀਗੀਆਂ ਸਿਆਣਿਆਂ ਦੀਆਂ ਕਹਾਵਤਾਂ ਸੀਗੀਆਂ ਉਹ ਆਪਣੇ ਘਰ ਵਿੱਚ ਫੋਟੋਆਂ ਹੋਣੀਆਂ ਚਾਹੀਦੀਆਂ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਓ ਬੱਚਿਆਂ ਨੂੰ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੁਰਾਣੇ ਪਿਛੋਕੜ ਜੋ ਸੱਭਿਆਚਾਰ ਕੱਚੇ ਘਰਾਂ ਵਾਸ ਬਾਰੇ ਪਾਣੀ ਘੜਿਆਂ ਵਿੱਚ ਪੀਣ ਬਾਰੇ ਹੋਰ ਗੱਡਿਆਂ ਗੱਡਿਆਂ ਉੱਤੇ ਕਿਵੇਂ ਬਜ਼ੁਰਗ ਦੀ ਦਾ ਪੱਠੇ ਲੈ ਕੇ ਆਉਂਦੇ ਸੀ ਜਾਂ ਕਿਵੇਂ ਸਵੇਰੇ ਹੱਥੀਂ ਦੁੱਧ ਰਿੜਕਿਆ ਜਾਂਦਾ ਸੀਗਾ ਹੱਥੀਂ ਟੋਕਾ ਕੀਤਾ ਜਾਂਦਾ ਸੀਗਾ ਹੁਣ ਸਭ ਮਸ਼ੀਨੀ ਯੁੱਗ ਹੋ ਗਿਆ ਬੱਚਿਆਂ ਨੂੰ ਇਹ ਸ ਸਿਖਾਇਆ ਜਾਵੇ ਕਿ ਆਪਣੇ ਸਰੀਰ ਨੂੰ ਤਰਾਸ਼ਣ ਲਈ ਆਪਣੇ ਸੱਭਿਆਚਾਰ ਨੂੰ ਕਾਇਮ ਰੱ ਰੱਖਿਆ ਜਾ ਜਾਣਾ ਚਾਹੀਦਾ ਅਤੇ ਆਪਣੇ ਪਛਾਣ ਜੋ ਆਪਣਾ ਵਿਰਸਾ ਆਪਣੇ ਗੀਤ ਗੀਤ ਬੋਲੀਆਂ ਹੋ ਗਈਆਂ ਜਾਂ ਆਪਣੇ ਆ ਖੇਡਾਂ ਕਬੱਡੀ ਹੋ ਗਈਆਂ ਆਪਣੇ ਪੂਰੇ ਕਲਚਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੋ ਆਪਣੇ ਬੱਚਿਆਂ ਨੂੰ ਇਹ ਸਿਖਾਵਾਂਗੇ ਸੋ ਫਿਰ ਹੀ ਸਿੱਖਣਗੇ ਆਪਣੇ ਬੱਚੇ ਵਾਂਝੇ ਨਾ ਰਹਿਣ ਇਸ ਕਰਕੇ ਪੰਜਾਬੀ ਨੂੰ ਜ਼ਿਆਦਾ ਉਹਨਾਂ ਉਹਨਾਂ ਨੂੰ ਸ ਸਿਖਾਇਆ ਜਾਵੇ